ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਪੰਜਾਬ ਦਾ ਸਾਹਮਣਾ ਕਰ ਰਹੀਆਂ ਪ੍ਰਮੁੱਖ ਵਪਾਰਕ ਚੁਣੌਤੀਆਂ ਜਾਂ ਮੁੱਦੇ ਕੀ ਹਨ ਇਹ ਵਪਾਰ ਦੇ ਵਿੱਚ ਬਹੁਤ ਹੀ ਕੰਪੀਟੀਸ਼ਨ ਵਾਲਾ ਮਾਹੌਲ ਹੋ ਰਿਹਾ ਜਿਵੇਂ ਕਿ ਆਪਾਂ ਦੇਖੀਏ ਔਨਲਾਈਨ ਸ਼ਿਸ਼ਟਮ ਔਨਲਾਈਨ 'ਤੇ ਚੀਜ਼ਾਂ ਵਿਕ ਰਹੀਆਂ ਨੇ ਅਤੇ ਜਿਹਨਾਂ ਨੇ ਕਿ ਆਪਣੇ ਹੀ ਕੁਛ ਦੁਕਾਨਦਾਰ ਨੇ ਜੋ ਲੋਕਾਂ ਨੂੰ ਬਹੁਤ ਸਿਆਣਾ ਕਰਤਾ ਅਤੇ ਉਹ ਹਰੇਕ ਦੁਕਾਨ 'ਤੇ ਟਰਾਈ ਕਰਨ ਦੇ ਬਾਅਦ ਬਾਅਦ ਵੀ ਰੇਟ ਘਟਾਉਣ ਜਾਂ ਹੋਰ ਉਧਾਰ ਲੈਣ ਲਈ ਜਾਂ ਹੋਰ ਕਰਨਾ ਇਹ ਚੀਜ਼ਾਂ ਦਾ ਦੁਕਾਨਦਾਰ ਦੇ ਉੱਤੇ ਬਹੁਤ ਮਾੜਾ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਅਤੇ ਇਹਦੇ 'ਤੇ ਇਹ ਮੁਕਾਬਲਾ ਜਾਂ ਕੋਈ ਨਿਯਮ ਹੋਰ ਹੁੰਦੇ ਹੀ ਆ ਆਪਣੇ ਪੰਜਾਬ ਦੇ ਵਿੱਚ ਜਾਂ ਕੋਈ ਜਿਵੇਂ ਕਿ ਕਹਿ ਦਿੰਦੇ ਹਾਂ ਕਿ ਵੀ ਕਿਸਾਨਾਂ ਨੂੰ ਐਮ ਐਸ ਪੀ ਮਿਲੇ ਕਿਸੇ ਵੀ ਚੀਜ਼ 'ਤੇ ਹੋਰ ਹੈ ਜਾਂ ਹੋਰ ਵੀ ਇਹੀ ਰੇਟ ਉਰੇ ਵਿਕਣੀ ਹੈ ਉਹੀ ਆ ਇਹ ਕੋਈ ਸ਼ ਕੋਈ ਵੀ ਆਪਣੇ ਉਰੇ ਸਥਿਤੀ ਨਹੀਂ ਹੈਗੀ ਵੀ ਆਪਾਂ ਐ ਕਰ ਦਈਏ ਅਤੇ ਪੰਜਾਬ ਦੇ ਵਿੱਚ ਆਪਣੇ ਆਪਣੇ ਬਿਜਨਸ ਜਾਂ ਹੋਰ ਦੇ ਢਾਂਚੇ ਦੀ ਗੱਲ ਕਰੀਏ ਤਾਂ ਉਹ ਆਪਣੇ ਜੋ ਨੌਜਵਾਨ ਪੀੜ੍ਹੀ ਆ ਉਹ ਬਾਹਰ ਦਾ ਰੁਖ ਜ਼ਿਆਦਾ ਕਰਨ ਦੇ ਕਾਰਨ ਅਤੇ ਪੰਜਾਬ ਦੇ ਵਿੱਚ ਵਪਾਰਕ ਸਾਂਝ ਬਹੁਤ ਘੱਟ ਰਹੀ ਹੈ ਅਤੇ ਔਨਲਾਈਨ ਵੀ ਵੱਧ ਰਹੀ ਹੈ ਜਾਂ ਕੁਛ ਐਂ ਲਗਾ ਲਓ ਵੀ ਆਪਣੇ ਵੀਹ ਕੁ ਪਰਸੈਂਟ ਔਨਲਾਈਨ ਹੋ ਗਏ ਤੀਹ ਚਾਲੀ ਪਰਸੈਂਟ ਆਪਣੇ ਬਾਹਰ ਚਲੇ ਗਏ ਰਹਿ ਗਏ ਉਹੀ ਚਾਲੀ ਪੰਜਾਹ ਪਰਸੈਂਟ ਲੋਕ ਰਹਿ ਗਏ ਜੋ ਤੀਹ ਚਾਲੀ ਪਰਸੈਂਟ ਰਹਿ ਗਏ ਜੋ ਕਿ ਵਪਾਰਕ ਦੇ ਵਿੱਚ ਵੰਡੇ ਹੋਏ ਨੇ ਜੋ ਕਿ ਚਾਲੀ ਪਰਸੈਂਟ ਬਹੁਤ ਘੱਟ ਹੈ ਕਿਉਂਕਿ ਦੁਕਾਨਦਾਰ ਦੁਕਾਨਾਂ ਬਹੁਤ ਜ਼ਿਆਦਾ ਨੇ